ਮੈਂ ਰਜਿਸਟਰੇਸ਼ਨ ਦਫ਼ਤਰ ਗਈ ਅਤੇ ਉੱਥੇ ਜਾ ਕੇ ਉੱਥੇ ਬੈਠੇ ਅਫ਼ਸਰਾਂ ਨੂੰ ਕਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ ਮੇਰੇ ਬੱਚੇ ਦੇ ਜਨਮ ਰਿਕਾਰਡ ਵਿੱਚ ਇੱਕ ਗਲਤੀ ਪਾਈ ਗਈ ਹੈ ਜੋ ਕਿ ਇਹ ਹੈ ਕਿ ਇਸ ਰਿਕਾਰਡ ਵਿੱਚ ਹਸਪਤਾਲ ਦਾ ਨਾਮ ਗਲਤ ਦਰਜ ਕੀਤਾ ਗਿਆ ਹੈ ਮੇਰੀ ਬੇਨਤੀ ਇਹ ਹੈ ਕਿ ਇਸ ਨੂੰ ਸਹੀ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਬਚਿਆ ਜਾ ਸਕੇ ਸੋ ਆਪ ਨੂੰ ਬੇਨਤੀ ਹੈ ਕਿ ਹਸਪਤਾਲ ਦਾ ਨਾਮ ਸਹੀ ਲਿਖ ਦਿੱਤਾ ਜਾਵੇ ਇਹ ਮੈਡੀਕਲ ਰਿਕਾਰਡ ਮੇਰੇ ਕੋਲ ਹੈ ਤੁਸੀਂ ਇਸ ਵਿੱਚੋਂ ਹਸਪਤਾਲ ਦਾ ਨਾਮ ਦੇਖ ਕੇ ਬੱਚੇ ਦੇ ਜਨਮ ਰਿਕਾਰਡ ਵਿੱਚ ਸਹੀ ਕਰ ਦਿਓ